ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਰੋਪੜ ਟੈਕਸੀ ਸਟੈਂਡ ਤੋਂ ਬੋਲਦੇ ਹੋ ਮੇਰੀ ਧੀ ਦਾ ਨਾ ਵਿਆਹ ਹੈ ਅਤੇ ਅਸੀਂ ਚੰਡੀਗੜ੍ਹ ਕੱਪੜੇ ਦੀ ਖਰੀਦਦਾਰ ਕਰ ਖਰੀਦੀ ਕਰਨ ਜਾਣਾ ਜਾਣਾ ਹੈ ਜਿਸਦਾ ਕਿ ਪੱਚੀ ਤਰੀਕ ਨੂੰ ਸਵੇਰੇ ਛੇ ਵਜੇ ਰੈਲ ਮਾਜਰੇ ਤੋਂ ਬੋਲਦੇ ਹਾਂ ਰੈਲ ਮਾਜਰੇ ਮੇਨ ਰੋਡ ਤੋਂ ਅਸੀਂ ਜਾਣਾ ਹੈ ਜਾਂਦੇ ਹੋਏ ਅਸੀਂ ਇੱਕ ਰਿਸ਼ਤੇਦਾਰੀ ਵਿੱਚ ਵੀ ਰੁਕਾਂਗੇ ਖਰੜ ਉਸ ਤੋਂ ਬਾਅਦ ਅਸੀਂ ਬਾਈ ਦੀ ਮਾਰਕਿਟ ਵਿੱਚ ਜਾਣਾ ਅਤੇ ਕੱਪੜੇ ਦੀ ਖਰੀਦਦਾਰੀ ਕਰਨੀ ਹੈ ਔਰ ਚੰਡੀਗੜ੍ਹ ਥੋੜ੍ਹਾ ਇੱਕ ਹੋਰ ਸਾਡੀ ਰਿਸ਼ਤੇਦਾਰੀ ਉੱਥੇ ਵੀ ਜਾਣਾ ਹੈ ਜਿਸ ਦਾ ਕਿ ਸਾਨੂੰ ਜੰਦ ਪੰਜ ਸੱਤ ਅੱਠ ਘੰਟੇ ਲੱਗ ਜਾਣੇ ਆ ਕੀ ਤੁਹਾਡਾ ਕੀ ਰੇਟ ਲੈਂਦੇ ਹੋ ਤੁਸੀਂ ਜਾਣ ਦਾ ਆਉਂਦੇ ਟੈਮ ਅਤੇ ਅਸੀਂ ਸੱਤ ਅੱਠ ਜੀਆਂ ਨੇ ਜਾਣਾ ਹੈ ਵੱਡੀ ਗੱਡੀ ਚਾਹੀਦੀ ਹੈ ਕਿੰਨਾ ਰੇਟ ਲੱਗੇਗਾ ਅਤੇ ਕਿੰਨੇ ਪੈਸ ਕਿੰਨੇ ਵਜੇ ਤੁਸੀਂ ਇੱਥੇ ਸਾਡੇ ਕੋਲ ਪਹੁੰਚੋਂਗੇ ਅਤੇ ਸਮ ਸਾਰਾ ਕੁਛ ਸੈਟ ਤਰੀਕ ਸੈਟ ਸਾਰਾ ਸਮਾਂ ਕਰਕੇ ਸਾਡੇ ਫੋਨ 'ਤੇ ਮੈਂ ਤੁਹਾਡੀ ਵੇਟ ਕਰਾਂਗੀ ਤਾਂ ਤੁਸੀਂ ਸਾਨੂੰ ਸ਼ਾਮ ਨੂੰ ਇੱਕ ਵਾਰੀ ਫੋਨ ਕਰਕੇ ਦੱਸ ਦਿਓ ਤੁਹਾਡੀ ਬਹੁਤ ਮਿਹਰਬਾਨੀ